ਸਤਿ ਸ਼੍ਰੀ ਅਕਾਲ ਮੈਨੂੰ ਨਾ ਜਿਹੜੀਆਂ ਫਿਲਮਾਂ ਥੋੜ੍ਹੀਆਂ ਜਿਹੀਆਂ ਜੁਰਮ ਦੇ ਨਾਲ ਸੰਬੰਧਿਤ ਹੁੰਦੀਆਂ ਜਾਂ ਕ੍ਰਾਈਮ ਦੇ ਨਾਲ ਸੰਬੰਧਿਤ ਹੁੰਦੀਆਂ ਆ ਉਹ ਮੈਨੂੰ ਬਹੁਤ ਪਸੰਦ ਆਉਂਦੀਆਂ ਆ ਕਿਉਂਕਿ ਮੇਰਾ ਥੋੜ੍ਹਾ ਜਿਹਾ ਜਿਹੜਾ ਸ਼ੁਰੂ ਤੋਂ ਹੀ ਅ ਸ਼ੌਂਕ ਰਿਹਾ ਆ ਫਿਲਮਾਂ ਨੂੰ ਲੈ ਕੇ ਉਹ ਮੇਰਾ ਥੋੜ੍ਹਾ ਜਿਹਾ ਜਿਹੜੀਆਂ ਸਸਪੈਂਸ ਵਾਲੀਆਂ ਫਿਲਮਾਂ ਹੁੰਦੀਆਂ ਨਾ ਉਹ ਜ਼ਿਆਦਾ ਮੈਨੂੰ ਪਸੰਦ ਆ ਅਤੇ ਮੈਂ ਥੋੜ੍ਹੇ ਦਿਨ ਪਹਿਲਾਂ ਨੈੱਟਫਲਿਕਸ 'ਤੇ ਇੱਕ ਵੈਬ ਸੀਰੀਜ਼ ਵੇਖੀ ਸੀਗੀ ਜਿਹੜੀ ਕਿ ਸੀਗੀ ਦਿੱਲੀ ਕ੍ਰਾਈਮ ਉਹ ਮੈਨੂੰ ਬਹੁਤ ਪਸੰਦ ਆਈ ਸੀਗੀ ਜਿੱਦਾਂ ਉਹਦੇ 'ਚ ਤੁਸੀਂ ਵੀ ਜੇ ਦੇਖੋਗੇ ਤਾਂ ਉਹਦੇ ਵਿੱਚ ਮਤਲਬ ਦਿੱਲੀ 'ਚ ਜਿਹੜਾ ਕ ਕ੍ਰਾਈਮ ਹੋਇਆ ਸੀਗਾ ਕੁੜੀ ਨਾਲ ਜਿਹੜਾ ਗੈਂਗ ਰੇਪ ਹੋਇਆ ਸੀਗਾ ਬੱਸ ਵਿੱਚ ਉਹਦਾ ਬਹੁਤ ਮਤਲਬ ਸੋਹਣੇ ਤਰੀਕੇ ਨਾਲ ਉਹਦਾ ਦੱਸਿਆ ਹੋਇਆ ਉਹਦਾ ਇੱਕ ਬਹੁਤ ਸੋਹਣਾ ਉਹਦਾ ਇੱਕ ਨਿਚੋੜ ਕੱਢ ਕੇ ਦੱਸਿਆ ਹੋਇਆ ਬਹੁਤ ਜੇ ਤੁਸੀਂ ਉਹਨੂੰ ਉਹਨੂੰ ਸੀਰੀਜ਼ ਨੂੰ ਧਿਆਨ ਨਾਲ ਵੇਖੋਗੇ ਤਾਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਲੂ ਕੰਡੇ ਖੜ੍ਹੇ ਹੋ ਜਾਂਦੇ ਆ ਤੁਹਾਨੂੰ ਰੋਣਾ ਆ ਜਾਂਦਾ ਵੇਖ ਕੇ ਕਿ ਇੱਦਾਂ ਵੀ ਹੋ ਸਕਦਾ ਅਤੇ ਮੇਰਾ ਤਾਂ ਮੇਨ ਤੁਹਾਨੂੰ ਦੱਸਣ ਦਾ ਸੀਗਾ ਕਿ ਮੈਨੂੰ ਥੋੜ੍ਹੀਆਂ ਜਿਹੀਆਂ ਕ੍ਰਾਈਮ ਦੇ ਸੰਬੰਧਿਤ ਫਿਲਮਾਂ ਜਿਹੜੀਆਂ ਉਹ ਬਹੁਤ ਪਸੰਦ ਆਉਂਦੀਆਂ ਅਤੇ ਮੇਰੀ ਜਿਹੜੀ ਪਸੰਦੀਦਾ ਜਿਹੜੀ ਹੈਗੀ ਆ ਉਹ ਹੈਗੀ ਆ ਦਿੱਲੀ ਕ੍ਰਾਈਮ ਉਹਦੇ 'ਚ ਉਹ ਮੈਨੂੰ ਬਹੁਤ ਸੋਹਣੀ ਲੱਗੀ ਸੀਗੀ ਵੈਬ ਸੀਰੀਜ਼ ਉਹ ਮੈਂ ਦੇਖੀ ਸੀਗੀ ਥੋੜ੍ਹੇ ਟਾਈਮ ਪਹਿਲਾਂ ਦਸ ਕੁ ਦਿਨਾਂ ਪਹਿਲਾਂ ਦੇਖੀ ਸੀਗੀ ਅਤੇ ਮੈਨੂੰ ਬਹੁਤ ਪਸੰਦ ਆਈ ਸੀਗੀ ਅਤੇ ਕਿਸੇ ਨੇ ਵੀ ਵੇਖਣੀ ਹੋਏ ਮਤਲਬ ਉਹਦਾ ਜਿਹੜਾ ਕਿਸੇ ਨੇ ਵੀ ਉਸ ਉਹਦੇ ਰਿਲੇਟਡ ਜੇ ਨੋਲੇਜ ਲੈਣੀ ਹੋਏ ਕਿ ਹਾਂ ਕਿੱਦਾਂ ਉਹਦੇ 'ਚ ਲੇਡੀ ਜਿਹੜੀ ਪੁਲਿਸ ਵਾਲੀ ਸੀਗੀ ਉਹਨੇ ਕਿੱਦਾਂ ਉਹਨੂੰ ਕੁੜੀ ਨੂੰ ਜਸਟਿਸ ਦਵਾਇਆ ਉਹਦੇ ਮਾਂ ਪਿਓ ਨੂੰ ਜਸਟਿਸ ਦਵਾਇਆ ਤਾਂ ਉਹ ਕੁੜੀ ਕੁੜੀ ਨਾਲ ਜੋ ਹੋਇਆ ਉਹਦਾ ਸਭ ਕੁਛ ਕਿ ਚੰਗਾ ਹੋਇਆ ਮਾੜਾ ਹੋਇਆ ਜੋ ਵੀ ਉਹਦੇ ਨਾਲ ਬੁਰਾ ਹੋਇਆ ਉਹਦੇ ਨਾਲ ਬਹੁਤ ਜ਼ਿਆਦਾ ਕਿਸੇ ਨਾਲ ਵੀ ਹੋਣਾ ਨਹੀਂ ਚਾਹੀਦਾ ਪਰ ਜੋ ਵੀ ਉਹਦੇ ਨਾਲ ਹੋਇਆ ਸੀਗਾ ਉਸ ਟਾਈਮ 'ਤੇ ਉਹਨੂੰ ਜੇ ਤੁਸੀਂ ਖੁਦ ਆਪਣਾ ਖੁਦ ਐਕਸਪੀਰੀਐਂਸ ਕਰਨਾ ਚਾਹੁੰਦੇ ਆ ਤਾਂ ਤੁਸੀਂ ਔਹ ਮੂਵੀ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੇਗੀ ਮਤਲਬ ਮੇਰੀ ਤਾਂ ਪਸੰਦੀਦਾ ਮੂਵੀ ਉਹੀ ਆ ਅਤੇ ਬਹੁਤ ਮੈਨੂੰ ਤਾਂ ਬਹੁਤ ਪਸੰਦ ਆਈ ਸੀਗੀ ਅਤੇ ਮੈਂ ਤੁਹਾਨੂੰ ਵੀ ਇਹੀ ਕਹੂੰਗੀ ਕਿ ਜੇ ਤੁਸੀਂ ਵੇਖਣੀ ਹੈ ਤਾਂ ਤੁਸੀਂ ਉਹ ਵੇਖੋ ਤੁਹਾਨੂੰ ਬਹੁਤ ਪਸੰਦ ਆਊਗੀ